ਖੇਤੀਬਾੜੀ ਵਿੱਚ ਸਰਕਾਰ ਬਹੁਤ ਹੀ ਕਿਸਾਨਾਂ ਦੀ ਮਦਦ ਕਰਦੀ ਹੈ ਸਰਕਾਰਾਂ ਵੱਲੋਂ ਬਹੁਤ ਸਾਰੇ ਲਾਭ ਹਨ ਜੋ ਕਿਸਾਨਾਂ ਨੂੰ ਦਿੱਤੇ ਜਾਂਦੇ ਹਨ ਜਿਵੇਂ ਕਿ ਹਰ ਸਾਲ ਮੋਦੀ ਸਰਕਾਰ ਕਿਸਾਨਾਂ ਨੂੰ ਛੇ ਹਜ਼ਾਰ ਰੁਪਈਆ ਦਿੰਦੇ ਦਿੰਦੀ ਹੈ ਜੋ ਕਿ ਤਿੰਨ ਕਿਸ਼ਤਾਂ ਵਿੱਚ ਦੋ ਦੋ ਹਜ਼ਾਰ ਰੁਪਈਆ ਕਿਸਾਨਾਂ ਨੂੰ ਪ੍ਰਾਪਤ ਹੁੰਦਾ ਹੈ ਕਿਸਾਨ ਉਸ ਪੈਸਿਆਂ ਤੋਂ ਖਾਦ ਦਵਾਈ ਅਤੇ ਬੀਜ ਅਤੇ ਹੋਰ ਵੀ ਚੀਜ਼ਾਂ ਲੈ ਸਕਦੇ ਹਨ ਜੋ ਕਿ ਉਹਨਾਂ ਨੂੰ ਖੇਤੀਬਾੜੀ ਵਿੱਚ ਕੰਮ ਆ ਸਕਦੀਆਂ ਹਨ ਹੋਰ ਦੇਖਿਆ ਜਾਵੇ ਤਾਂ ਸਰਕਾਰਾਂ ਕਿਸਾਨਾਂ ਨੂੰ ਕਰਜ਼ੇ ਦੇਣ ਵਿੱਚ ਵੀ ਸਹਾਇਤਾ ਕਰਦੀਆਂ ਹਨ ਜਿਵੇਂ ਕਿ ਕਿਸੇ ਕਿਸਾਨ ਨੇ ਕੋਈ ਵੀ ਮਸ਼ੀਨੀ ਸਾਧਨ ਲੈਣਾ ਹੋਵੇ ਜਿਵੇਂ ਕਿ ਟਰੈਕਟਰ ਕੰਬਾਈਨ ਹੱਲਾਂ ਟਰਾਲੀ ਸੁਪਰ ਸੀਡਰ ਜੋ ਕਿ ਖੇਤੀਬਾੜੀ ਕਰਨ ਵਿੱਚ ਕੰਮ ਆਉਂਦਾ ਹੈ ਉਹ ਵੀ ਕਿਸਾਨ ਬੈਂਕਾਂ ਤੋਂ ਲੋਨ ਲੈ ਕੇ ਕੋਈ ਵੀ ਮਸ਼ੀਨ ਲੈ ਸਕਦਾ ਹੈ ਅਤੇ ਉਹਨਾਂ ਨੂੰ ਬਹੁਤ ਹੀ ਘੱਟ ਵਿਆਜ 'ਤੇ ਇਹ ਕਰਜੇ ਪ੍ਰਾਪਤ ਹੁੰਦੇ ਹਨ ਕਿਸਾਨ ਨੂੰ ਹਰ ਸਾਲ ਹੀ ਸਬਸਿਡੀ ਵੀ ਪ੍ਰਾਪਤ ਹੁੰਦੀ ਹੈ ਜੋ ਕਿ ਸਰਕ ਜੋ ਕਿ ਕਿਸਾਨਾਂ ਨੂੰ ਬਹੁਤ ਹੀ ਰਾਹਤ ਮਿਲਦੀ ਹੈ ਕਰਜੇ ਉਤਾਰਨ ਲਈ